ਇੱਕ ਵਾਰ ਦੀ ਗੱਲ ਹੈ ਮੈਂ ਆਪਣੀ ਕਮੀਜ਼ ਉੱਤੇ ਬਹੁਤ ਹੀ ਸੁੰਦਰ ਕਢਾਈ ਕੀਤੀ ਸੀ ਮਗਰ ਉਸ ਕਢਾਈ ਦਾ ਡਿਜ਼ਾਇਨ ਮੇਰੀ ਮੰਮੀ ਨੂੰ ਪਸੰਦ ਨਹੀਂ ਆਇਆ ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਕਢਾਈ ਸੋਹਣੀ ਨਹੀਂ ਲੱਗ ਰਹੀ ਇਸ ਦੇ ਵਿੱਚ ਜਿਹੜੇ ਰੰਗ ਤੂੰ ਇਸਤੇਮਾਲ ਕੀਤੇ ਨੇ ਉਹ ਇਸ ਕੱਪੜੇ ਦੇ ਰੰਗ ਨਾਲ ਮੈਚ ਨਹੀਂ ਕਰ ਰਹੇ ਇਸ ਦਾ ਉਠਾ ਨਹੀਂ ਆ ਰਿਹਾ ਇਸ ਕਰਕੇ ਤੈਨੂੰ ਇਹ ਡਿਜ਼ਾਇਨ ਇਹ ਚੇਂਜ ਬਦਲਣਾ ਪਏਗਾ ਅਤੇ ਤੂੰ ਇਸ 'ਤੇ ਹੋਰ ਕੋਈ ਡਿਜ਼ਾਈਨ ਬਣਾ ਫਿਰ ਮੈਂ ਕੀ ਕੀਤਾ ਉਸ ਦੇ ਉੱਤੇ ਹੋਰ ਹੋਰ ਤਰ੍ਹਾਂ ਦਾ ਡ ਡਿਜ਼ਾਇਨ ਬਣਾਉਣ ਦੀ ਕੋਸ਼ਿਸ਼ ਕੀਤੀ ਮਗਰ ਮੇਰਾ ਸਭ ਤੋਂ ਚੁਣੌਤੀਪੂਰਨ ਕੰਮ ਇਹ ਸੀ ਕਿ ਉਹਦੇ ਵਿੱਚ ਉਸ ਡਿਜ਼ਾਇਨ ਦੇ ਦੇ ਨਾਲ ਉਸ ਕੱਪੜੇ ਦੇ ਨਾਲ ਮੇਲ ਖਾਂਦੇ ਹੋਏ ਧਾਗੇ ਮੈਨੂੰ ਮੇਰੇ ਕੋਲ ਉਪਲਬਧ ਨਹੀਂ ਸਨ ਅਤੇ ਫਿਰ ਮੈਨੂੰ ਉਹਦੇ ਉਸਦੇ ਲਈ ਉਸ ਉਸ ਤਰ੍ਹਾਂ ਦੇ ਧਾਗਿਆਂ ਨੂੰ ਪਹਿਲੇ ਰੰਗ ਕਰਨਾ ਪਿਆ ਫਿਰ ਉਸ ਧਾਗਿਆਂ ਦਾ ਇਸਤੇਮਾਲ ਕਰਨ ਤੋਂ ਬਾਅਦ ਮੇਰੀ ਕਢਾਈ ਬਹੁਤ ਹੀ ਸੋਹਣੀ ਅਤੇ ਸੁਨੱਖੀ ਲੱਗਣ ਲੱਗ ਪਈ ਅਤੇ ਮੈਂ ਬਹੁਤ ਹੀ ਖੁਸ਼ ਸੀ ਕਿ ਮੇਰੇ ਦੁਆਰਾ ਕੀਤੀ ਹੋਈ ਕਢਾਈ ਬਹੁਤ ਹੀ ਸੁੰਦਰ ਲੱਗ ਰਹੀ ਹੈ ਅਤੇ ਮੇਰੀ ਮਾਤਾ ਜੀ ਵੀ ਇਸ ਗੱਲ ਨੂੰ ਦੇਖ ਕੇ ਬਹੁਤ ਹੀ ਖੁਸ਼ ਹੋਏ ਕਿ ਮੈਂ ਆਪਣਾ ਕੰਮ ਬਹੁਤ ਹੀ ਸੁਚੱਜੇ ਅਤੇ ਸੁਚਾਰੂ ਢੰਗ ਨਾਲ ਬਹੁਤ ਹੀ ਵਧੀਆ ਕੀਤਾ ਹੈ ਧੰਨਵਾਦ